ਕਈ ਸਾਲਾਂ ਤੋਂ ਫੋਟੋਗ੍ਰਾਫੀ ਇਸ ਲਈ ਬਦਲ ਗਈ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਮੋਬਾਇਲ ਮਤਲਬ ਬਟਨਾਂ ਵਾਲੇ ਸਨ ਅਤੇ ਉਹਨਾਂ ਵਿੱਚ ਕੈਮਰੇ ਨਹੀਂ ਸਨ ਹੌਲੀ ਹੌਲੀ ਉਹਨਾਂ ਵਿੱਚ ਕੈਮਰੇ ਆ ਗਏ ਅਤੇ ਮੋਬਾਇਲ ਕੈਮਰਿਆਂ ਦੇ ਵਿੱਚ ਅਸੀਂ ਕੋਈ ਵੀ ਕਿਤੇ ਵੀ ਫੋਟੋ ਲੈ ਸਕਦੇ ਆ ਆਪਣੀ ਯਾਦਾਂ ਰੱਖ ਸਕਦੇ ਹਾਂ ਪੁਰਾਣੇ ਕੈਮਰਿਆਂ ਵਿੱਚ ਇਸ ਤਰ੍ਹਾਂ ਅਸੀਂ ਸਮੇਂ ਵਿੱਚ ਜਦੋਂ ਕੋਈ ਫੰਕਸ਼ਨ ਹੋਣਾ ਜਾਂ ਕੋਈ ਪ੍ਰੋਗਰਾਮ ਹੋਣਾ ਉਸ 'ਤੇ ਕੈਮਰੇ ਵਾਲੇ ਨੂੰ ਸੱਦਣਾ ਅਤੇ ਕੈਮਰੇ ਵਾਲੇ ਤੋਂ ਹੀ ਫੋਟੋਆਂ ਕਰਵਾ ਸਕਦੇ ਸਨ ਜਦੋਂ ਕਿਤੇ ਜਾਣਾ ਹੁੰਦਾ ਸੀ ਅਤੇ ਨਹੀਂ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਆਪਣੀਆਂ ਯਾਦਾਂ ਨੂੰ ਕੈਦ ਰੱਖ ਸਕਦੇ ਓਂ ਅਤੇ ਕੈਮਰੇ ਦੇ ਵਿੱਚ ਤੁਸੀਂ ਆਪਣੀ ਵੀ ਕੋਈ ਵੀ ਕਿਤੇ ਵੀ ਜਾ ਕੇ ਫੋਟੋ ਖਿੱਚ ਸਕਦੇ ਹੋ ਅਤੇ ਉਹ ਤੁਹਾਡੇ ਕੋਲ ਡਾਟਾ ਵੀ ਸੇਫ ਰਹਿੰਦਾ ਹੈ ਅਤੇ ਤੁਸੀਂ ਕਦੋਂ ਵੀ ਉਹਦੀ ਕਢਵਾ ਸਕਦੇ ਹੋ ਅਤੇ ਪਰ ਪੁਰਾਣੇ ਕੈਮਰਿਆਂ ਦੇ ਐਸੀ ਫੋਟੋਗ੍ਰਾਫਰ ਹੀ ਫੋਟੋਆਂ ਕੱਢ ਕੇ ਦਿੰਦਾ ਸੀ ਅਤੇ ਉਹ ਤੁਹਾਡੇ ਕੋਲ ਸੇਵ ਨਹੀਂ ਹੁੰਦਾ ਸੀ ਅਤੇ ਅੱਜ ਕੱਲ੍ਹ ਡਿਟੀ ਡਿਜੀਟਾਈ ਲਾਈਜੇਸ਼ਨ ਦੀ ਮਤਲਬ ਇੰਨਾ ਫ਼ਰਕ ਪਾ ਦਿੱਤਾ ਤਾਂ ਹੁਣ ਵਾਲੇ ਕੈਮਰਿਆਂ ਦੇ ਵਿੱਚ ਬਹੁਤ ਫ਼ਰਕ ਪਿਆ ਹੈ ਅਤੇ ਇਸ ਦੇ ਵਿੱਚ ਆਪਾਂ ਕਿਸੇ ਵੀ ਸਮੇਂ ਕਦੋਂ ਵੀ ਆਪਣੀ ਯਾਦਾਂ ਫੋਟੋਆਂ ਖਿੱਚ ਕੇ ਰੱਖ ਸਕਦੇ